ਪੰਜਾਬ ਰਾਜਨੀਤਿਕ ਪ੍ਰਣਾਲੀ ਨਾਗਰਿਕ ਅਤੇ ਸਮਾਜਿਕ ਆਰਥਿਕਾਂ ਅਤੇ ਸਰਕਾਰ ਨੇ ਪਹਿਲਾਂ ਪੜ੍ਹਾਈ ਦਾ ਮੁਨਾਰ ਹੈ ਜਿਹੜਾ ਉੱਚਾ ਚੁੱਕਿਆ ਅਤੇ ਉਹਨਾਂ ਨੂੰ ਬਰਾਬਰ ਲੈ ਕੇ ਆਉਂਦਾ ਸਾਰਿਆਂ ਨੂੰ ਬਰਾਬਰ ਲੈ ਕੇ ਆਉਂਦਾ ਅਤੇ ਉਸ 'ਤੇ ਗਰੀਬੀ ਵੀ ਘਟਾਉਣ ਵਾਲੇ ਪ੍ਰੋਗਰਾਮ ਹੈ ਜਿਹੜੇ ਨੀਤੀਆਂ ਏ ਅਤੇ ਉਹਦੇ ਵਿੱਚ ਇੱਕ ਪੈਨਸ਼ਨ ਬੁਢਾਪਾ ਵੀ ਲਾਈ ਵੀ ਹੈ ਇਹਨਾਂ ਨੇ ਬੱਚਿਆਂ ਨੂੰ ਅ ਵਜ਼ੀਫਾ ਮਿਲਦਾ ਹੈ ਪੜ੍ਹਾਈ ਪਰ ਅਤੇ ਇਹ ਰਾਸ਼ਨ ਵੀ ਆਟਾ ਦਾਲ ਸਕੀਮ ਵੀ ਚਲਾਈ ਹੋਈ ਹੈ ਅਤੇ ਹੋਰ ਵੀ ਕਈ ਤਰ੍ਹਾਂ ਦੇ ਪ੍ਰੋਗਰਾਮ ਅਤੇ ਸਕੀਮਾਂ ਸਰਕਾਰ ਕੱਢਦੀ ਰਹਿੰਦੀ ਹੈ ਅਤੇ ਕੱਢੀਆਂ ਹੋਈਆਂ ਹਨ ਜਿਸ ਦਾ ਫ਼ਾਇਦਾ ਲੈ ਸਕਦੇ ਹਨ